ਸਟ੍ਰੀਮਿੰਗ ਅਤੇ ਵੀਡੀਓ ਸਮੱਗਰੀ ਬਣਾਉਣ ਦਾ ਕਈ ਤਰੀਕਿਆਂ ਨਾਲ ਗੇਮਿੰਗ ਉਦਯੋਗ 'ਤੇ ਮਹੱਤਵਪੂਰਨ ਪ੍ਰਭਾਵ ਪਿਆ ਹੈ ਵਧੀ ਹੋਈ ਪਹੁੰਚ ਯੋਗਤਾ ਸਟ੍ਰੀਮਿੰਗ ਪਲੇਟਫਾਰਮਾਂ ਜਿਵੇਂ ਕਿ ਟਵਿੱਚ ਯੂਟਿਊਬ ਗੇਮਿੰਗ ਅਤੇ ਮਿਕਸਰ ਨੇ ਗੇਮਿੰਗ ਸਮੱਗਰੀ ਨੂੰ ਵਿਸ਼ਾਲ ਦਰਸ਼ਕ ਲਈ ਵਧੇਰੇ ਪਹੁੰਚ ਯੋਗ ਬਣਾ ਦਿੱਤਾ ਹੈ ਦਰਸ਼ਕ ਆਪਣੇ ਸਥਾਨ ਜਾਂ ਗੇਮਿੰਗ ਪਲੇਟਫਾਰਮ ਦੀ ਪਰਵਾਹ ਕੀਤੇ ਬਿਨਾਂ ਆਪਣੇ ਸ ਪਸੰਦੀਦਾ ਗੇਮਰ ਅਤੇ ਸਿਰਜਣਹਾਰਾਂ ਤੋਂ ਲਾਈਵ ਗੇਮ ਪਲੇ ਟਿਊਟੋਰੀਅਲ ਸਮੀਖਿਆਮਾਂ ਅਤੇ ਮਨੋਰੰਜਨ ਸਮੱਗਰੀ ਦੇਖ ਸਕਦੇ ਹਨ ਕਮਿਊਨਟੀ ਰੁਝੇਵੇਂ ਸਟ੍ਰੀਮਿੰਗ ਪਲੇਟਫਾਰਮ ਗੇਮਰ ਜਾਂ ਸਮੱਗਰੀ ਸਿਰਜਣਹਾਰਾਂ ਅਤੇ ਦਰਸ਼ਕਾਂ ਵਿੱਚਕਾਰ ਭਾਈਚਾਰਕ ਸ਼ਮੂਲੀਅਤ ਅਤੇ ਪਰਸਪਰ ਪ੍ਰਭਾਵ ਨੂੰ ਉਤਸ਼ਾਹਿਤ ਕਰਦੇ ਹਨ ਲਾਈਵ ਚੈਟ ਵਿਸ਼ੇਸ਼ਤਾਵਾਂ ਦਰਸ਼ਕਾਂ ਨੂੰ ਰੀਅਲ ਟਾਈਮ ਵਿੱਚ ਸਟਰੀਮਰਾਂ ਨਾਲ ਗੱਲਬਾਤ ਕਰਨ ਸੁਆਲ ਪੁੱਛਣ ਫੀ ਫੀਡਬੈਕ ਦੀ ਪਸ਼ ਪੇਸ਼ਕਸ਼ ਕਰਨ ਅਤੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਣ ਗੇਮਿੰਗ ਸਮੱਗਰੀ ਦੇ ਆਲੇ ਦੁਆਲੇ ਭਾਈਚਾਰੇ ਅਤੇ ਦੋਸਤੀ ਦੀ ਭਾਵਨਾ ਪੈਦਾ ਕਰਨ ਦੀ ਇਜਾਜ਼ਤ ਦਿੰਦੀਆਂ ਹਨ ਸਮੱਗਰੀ ਖੋਜ ਸਟ੍ਰੀਮਿੰਗ ਪਲੇਟਫਾਰਮ ਨਵੀਆਂ ਗੇਮਾਂ ਸ਼ੈੱਲੀਆਂ ਅਤੇ ਸਮੱਗਰੀ ਸਿਰਜਾਣਹਾਰਾਂ ਲਈ ਕੀਮਤੀ ਖੋਜ ਪਲੇਟਫਾਰਮ ਵੱਜੋਂ ਕੰਮ ਕਰਦੇ ਹਨ ਦਰਸ਼ਕ ਗੇਮਿੰਗ ਸਮੱਗਰੀ ਦੀ ਵਿਭਿੰਨ ਸ਼੍ਰੇਣੀ ਨੂੰ ਖੋਜ ਅਤੇ ਪੜਚੋਲ ਕਰ ਸਕਦੇ ਹਨ ਜਿਸ ਵਿੱਚ ਇੰਡੀ ਗੇਮਾਂ ਵਿਸ਼ੇਸ਼ ਸ਼ੈਲੀਆਂ ਅਤੇ ਆਉਣ ਵਾਲੇ ਸਿਰਜਣਹਾਰ ਸ਼ਾਮਿਲ ਹਨ ਜਿਸ ਨਾਲ ਘੱਟ ਜਾਣੇ ਪਛਾਣੇ ਸਿਰਲੇਖਾਂ ਅਤੇ ਸਿਰਜਣਹਾਰਾਂ ਲਈ ਐਕਸਪੋਜਰ ਅਤੇ ਦ੍ਰਿਸ਼ਟੀ ਵਧਦੀ ਹੈ ਪ੍ਰਭਾਵ ਅਤੇ ਮਾਰਕੀਟਿੰਗ ਗੇਮਿੰਗ ਪ੍ਰਭਾਵ ਅਤੇ ਸਮੱਗਰੀ ਸਿਰਜਣਹਾਰ ਦਰਸ਼ਕ ਦੀਆਂ ਤਰਜੀਹਾਂ ਖਰੀਦਦਾਰੀ ਫੈਸਲਿਆਂ ਅਤੇ ਗੇਮਿੰਗ ਕਮਿਊਨਿਟੀ ਦੇ ਪਰੋ ਰੁਝਾਨਾਂ ਅਤੇ ਮਹੱਤਵਪੂਰਨ ਪ੍ਰਭਾਵ ਪਾਉਂਦੇ ਹਨ ਉਹਨਾਂ ਦੇ ਸਮਰਥਨ ਸਮੀਖਿਆਵਾਂ ਅਤੇ ਗੇਮ ਪਲੇ ਫੁਟੇਜ ਗੇਮ ਦੀ ਵਿਕਰੀ ਮਾਰਕੀਟਿੰਗ 'ਚ ਰਣਨੀਤੀਆਂ ਅਤੇ ਬ੍ਰਾਂਡ ਭਾਈਵਾਲੀ ਨੂੰ ਪ੍ਰਭਾਵਿਤ ਕਰ ਸਕਦੇ ਹਨ ਉਹਨਾਂ ਨੂੰ ਗੇਮ ਡਵੇਲਪਰਾਂ ਅਤੇ ਪ੍ਰਕਾਸ਼ਕਾਂ ਲਈ ਕੀਮਤੀ ਸੰਪੱਤੀਆਂ ਬਣਾਉਂਦੇ ਹਨ ਉਪਭੋਗਤਾ ਦੁਆਰਾ ਤਿਆਰ ਕੀਤੀ ਗਈ ਸਮੱਗਰੀ ਵੀਡੀਓ ਸਮੱਗਰੀ ਬਣਾਉਣ ਵਾਲੇ ਪਲੇਟਫਾਰਮ ਜਿਵੇਂ ਕਿ ਯੂਟਿਊਬ ਅਤੇ ਟਿੱਕਟੋਕ ਗੇਮਰਜ਼ ਨੂੰ ਉਪਭੋਗਤਾ ਦੁਆਰਾ ਤਿਆਰ ਸਮੱਗਰੀ ਬਣਉਣ ਅਤੇ ਸਾਂਝਾ ਕਰਨ ਦੇ ਯੋਗ ਬਣਾਉਂਦੇ ਹਨ ਜਿਸ ਵਿੱਚ ਗੇਮ ਪਲੇ ਹਾਈਲਾਈਟਸ ਮੋਂਟੇਜ ਟਿ ਟਿਊਟੋਰੀਅਲ ਅਤੇ ਮੀਮ ਸ਼ਾਮਿਲ ਹਨ ਉਪਭੋਗਤਾ ਦੁਆਰਾ ਤਿਆਰ ਕੀਤੀ ਸਮੱਗਰੀ ਗੇਮਿੰਗ ਸੱਭਿਆਚਾਰ ਦੇ ਵਾਇਰਲ ਫੈਲਣ ਵਿੱਚ ਯੋਗਦਾਨ ਪਾਉਂਦੀ ਹੈ ਅਤੇ ਗੇਮਿੰਗ ਕਮਿਊਨਿਟੀ ਵਿੱਚ ਰਚਨਾਤਮਕ ਅਤੇ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਦੀ ਹੈ ਸਪੋਰਟਸ ਅਤੇ ਪ੍ਰਤੀਯੋਗੀ ਗੇਮਿੰਗ ਸਟ੍ਰੀਮਿੰਗ ਪਲੇਟਫਾਰਮਾਂ ਐ ਸਪੋਰਟਸ ਅਤੇ ਪ੍ਰਤੀਯੋਗੀ ਗੇਮਿੰਗ ਦੇ ਵਿਕਾਸ ਅਤੇ ਪ੍ਰਸਿੱਧੀ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹਨ ਇ ਸਪੋਰਟਸ ਟੂਰਨਾਮੈਂਟਾਂ ਵਿੱਚ ਅਤੇ ਕ੍ਰਿਕਟ ਬੈਟਾਂ ਦੇ ਲਾਈਵ ਪ੍ਰਸਾਰਣ ਦੁਨੀਆ ਭਰ ਦੇ ਲੱਖਾਂ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ ਡ੍ਰਾਈਵਿੰਗ ਰੁਝੇਵੇਂ ਸਪਨਸ ਸਪੋਂਸਰਸ਼ਿਪ ਦੇ ਮੌਕੇ ਅਤੇ ਖਿਡਾਰੀਆਂ ਟੀਮਾਂ ਪ੍ਰਬੰਧਕਾਂ ਅਤੇ ਪਲੇਟਫਾਰਮਾਂ ਲਈ ਮਾਲੀਆਂ ਧਾਰਾਵਾਂ ਮੁਦਰੀਕਰਨ ਦੇ ਮੌਕੇ ਗੇਮਿੰਗ ਸਮੱਗਰੀ ਸਿਰਜਣਹਾਰ ਵਿਗਿਆਪਨ ਸਪੋਂਸਰਸ਼ਿਪਾਂ ਗਾਹਕੀਆਂ ਦਾਨ ਅਤੇ ਵਪਾਰਕ ਵਿਤਕਰੇ ਸਮੇਤ ਵੱਖ ਵੱਖ ਮਾਲੀਆ ਸਟ੍ਰੀਮਾਂ ਰਾਹੀਂ ਆਪਣੀ ਸਮੱਗਰੀ ਦਾ ਮੁਦਰੀਕਰਨ ਕਰ ਸਕਦੇ ਹਨ ਸਟ੍ਰੀਮਿੰਗ ਪਲੇਟਫਾਰਮ ਮੁਦਰੀਕਰਨ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦੇ ਹਨ ਜਿਵੇਂ ਕਿ ਵਿਗਿਆਪਨ ਮਾਲੀਆ ਸ਼ੇਰਿੰਗ ਚੈਨਲ ਸਬਸਕ੍ਰਿਪਸ਼ਨ ਅਤੇ ਵਰਚੂਅਲ ਮੁਦਰਾ ਟਿਪਿੰਗ ਸਿਰਜਾਣਹਾਰਾਂ ਨੂੰ ਗੇਮਿੰਗ ਲਈ ਉਹਨਾਂ ਦੇ ਜਨੂੰਨ ਤੋਂ ਆਮਦਨ ਕਮਾਉਣ ਦੇ ਯੋਗ ਬਣਾਉਂਦੇ ਹਨ ਕੁੱਲ ਮਿਲਾ ਕੇ ਸਟ੍ਰੀਮਿੰਗ ਅਤੇ ਵੀਡੀਓ ਸਮੱਗਰੀ ਨਿਰਮਾਣ ਨੇ ਗੇਮਿੰਗ ਸਮੱਗਰੀ ਦੇ ਉਤਪਾਦਨ ਵੰਡ ਅਤੇ ਖ਼ਪਤ ਨੂੰ ਜਮਹੂਰੀ ਬਣਾਇਆ ਹੈ ਗੇਮਰਜ਼ ਅਤੇ ਸਿਰਜਣਹਾਰਾਂ ਨੂੰ ਇੱਕ ਜੀਵੰਤ ਅਤੇ ਗਤੀਸ਼ੀਲ ਗੇਮਿੰਗ ਈਕੋਸਿਸਟਮ ਦੇ ਅੰਦਰ ਜੁੜਨ ਸਹਿਯੋਗ ਕਰਨ ਅਤੇ ਪ੍ਰਫੁਲਿੱਤ ਕਰਨ ਲਈ ਸ਼ਕਤੀ ਪ੍ਰਦਾਨ ਕੀਤਾ ਹੈ